ਸਤਿ ਸ਼੍ਰੀ ਅਕਾਲ ਜੀ ਤੁਸੀਂ ਤਰਸੇਮ ਸਵੀਟਸ ਖੇੜੀ ਨੌ ਸਿੰਘ ਤੋਂ ਬੋਲਦੇ ਹੋ ਸਾਡੇ ਘਰ ਵਿੱਚ ਜੋ ਪ੍ਰੋਗਰਾਮ ਹੋਣਾ ਸੀ ਉਸਦੇ ਲਈ ਤੁਹਾਡੇ ਸਵੀਟਸ ਸ਼ੌਪ ਤੋਂ ਕੁੱਝ ਪਕਵਾਨਾਂ ਲਈ ਆਡਰ ਪਾਇਆ ਸੀ ਤੁਹਾਡੇ ਦੁਆਰਾ ਉਹਨਾਂ ਪਕਵਾਨਾਂ ਦੇ ਭੇਜੇ ਗਏ ਸੈਂਪਲ ਘਰ ਵਿੱਚ ਕਿਸੇ ਨੂੰ ਪਸੰਦ ਨਹੀਂ ਆਏ ਅਤੇ ਨਾ ਹੀ ਖਾਣ ਵਿੱਚ ਸਵਾਦਿਸ਼ਟ ਸੀ ਅਤੇ ਜਿਹੜੀ ਪੈਕਿੰਗ ਵਿੱਚ ਆਏ ਸਨ ਉਹ ਪੈਕਿੰਗ ਵੀ ਫਟੀ ਹੋਈ ਸੀ ਸਹੀ ਤਰ੍ਹਾਂ ਨਹੀਂ ਕੀਤੀ ਹੋਈ ਸੀ ਪੈਕਿੰਗ ਜਿਸ ਕਰਕੇ ਤੁਹਾਨੂੰ ਦਿੱਤਾ ਪਕਵਾਨਾਂ ਦਾ ਔਡਰ ਅਸੀਂ ਰੱਦ ਕਰਨਾ ਚਾਹੁੰਦੇ ਹਾਂ